ਹਾਂਜੀ ਜਿਵੇਂ ਕਿ ਮੈਨੂੰ ਬਚਪਨ ਤੋਂ ਹੀ ਸ਼ੌਂਕ ਰਿਹਾ ਹੈ ਕਿ ਮੈਂ ਕੋਈ ਨਾ ਕੋਈ ਡਰਾਇੰਗ ਕਰਾਂ ਕੋਈ ਪਿਕਚਰ ਬਣਾਵਾਂ ਕੋਈ ਵੀ ਨੇਚਰ ਦੀ ਜਿਵੇਂ ਕੁਦਰਤ ਦਾ ਕੁਝ ਵੀ ਸੀਨਰੀ ਵਗੈਰਾ ਬਣਾਵਾਂ ਮੈਂ ਛੋਟੇ ਹੁੰਦੇ ਹੀ ਕਿਤਾਬਾਂ ਤੋਂ ਥੋੜ੍ਹਾ ਜਿਹਾ ਪਿਆਰ ਮੈਨੂੰ ਕਿਤਾਬਾਂ ਨਾਲ ਜ਼ਿਆਦਾ ਹੀ ਸੀ ਉਸ ਤੋਂ ਬਾਅਦ ਤਾਂ ਫਿਰ ਜਿਵੇਂ ਮੈਂ ਬੁੱਕਸ ਦੇ ਵਿੱਚ ਕਿਤਾਬਾਂ ਦੇ ਵਿੱਚ ਬਣੀ ਸੀਨਰੀ ਦੇਖਦੀ ਸੀ ਕੋਈ ਵੀ ਤਰ੍ਹਾਂ ਦੀ ਪਿਕਚਰ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਇਸ ਨੂੰ ਆਪਣੇ ਹੱਥ ਨਾਲ ਬਣਾਉਣਾ ਚਾਹੀਦਾ ਹੈ ਤਾਂ ਮੈਂ ਐਂ ਕਰਦੀ ਕਿਸੇ ਕਾਗਜ਼ ਦੇ ਉੱਪਰ ਜਾਂ ਡਰਾਇੰਗ ਸ਼ੀਟ ਦੇ ਉੱਪਰ ਬਣਾਉਂਦੀ ਤਾਂ ਮੈਨੂੰ ਅੱਛਾ ਲੱਗਦਾ ਫਿਰ ਹੁਣ ਮੈਂ ਰੰਗ ਵਗੈਰਾ ਕਰਦੀ ਰੰਗਾਂ ਨਾਲ ਸਜਾਉਂਦੀ ਇੱਦਾਂ ਹੀ ਕਰਦੇ ਕਰਦੇ ਇੱਕ ਵਾਰ ਮੇਰੀ ਬਣਾਈ ਹੋਈ ਤਸਵੀਰ ਮੇਰੇ ਅੰਕਲ ਜੀ ਨੂੰ ਜਿਵੇਂ ਪਸੰਦ ਆਈ ਤਾਂ ਉਹ ਜਿਵੇਂ ਪੱਤਰਕਾਰ ਸੀ ਨਿਊਜ਼ਪੇਪਰ ਵਗੈਰਾ ਦੇ ਵਿੱਚ ਉਹਨਾਂ ਦੀ ਨਿਊਜ਼ ਆਉਂਦੀ ਸੀ ਤਾਂ ਉਹਨਾਂ ਨੂੰ ਮੇਰੀ ਤਸਵੀਰ ਬਣਾਈ ਹੋਈ ਸੀਨਰੀ ਪਹਾੜਾਂ ਵਾਲੀ ਵਿੱਚ ਸਨ ਸੂਰਜ ਦਿਖਾਇਆ ਹੋਇਆ ਬਹੁਤ ਪਸੰਦ ਆਈ ਤਾਂ ਉਹ ਲੈ ਕੇ ਗਏ ਤਾਂ ਉਹਨਾਂ ਨੇ ਅਖਬਾਰ ਵਿੱਚ ਛਪਾ ਤੀ ਤਾਂ ਉਥੋਂ ਫਿਰ ਮੇਰਾ ਥੋੜ੍ਹਾ ਕਰੇਜ਼ ਹੋਰ ਜ਼ਿਆਦਾ ਵੱਧ ਗਿਆ ਕੀ ਹਾਂ ਮੈਂ ਥੋੜ੍ਹਾ ਅੱਗੇ ਨਿਕਲ ਸਕਦੀ ਹਾਂ ਤਾਂ ਕਰਦੇ ਕਰਦੇ ਮੇਰੀ ਤਸਵੀਰ ਸਾਰੇ ਕਿਤੇ ਸਭ ਨੇ ਪਸੰਦ ਕੀਤੀ ਮੇਰੇ ਆਸ ਪਾਸ ਦੇ ਦੋਸਤਾਂ ਮਿੱਤਰਾਂ ਨੇ ਜਾਂ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਪਤਾ ਲੱਗਿਆ ਕਿ ਸਾਡੀ ਕੁੜੀ ਦੀ ਬਣਾਈ ਗਈ ਫੋਟੋ ਅਖਬਾਰ ਵਿੱਚ ਆਈ ਹੈ ਇੱਦਾਂ ਹੀ ਫਿਰ ਮੇਰਾ ਸ਼ੌਂਕ ਹੋਰ ਵਧਦਾ ਗਿਆ ਫਿਰ ਮੋਬਾਈਲ ਦਾ ਜ਼ਮਾਨਾ ਆਇਆ ਤਾਂ ਮੋਬਾਇਲ ਦੇ ਕਰਕੇ ਫਿਰ ਕੈਮਰੇ ਰਾਹੀਂ ਫੋਨ ਦੇ ਵਿੱਚ ਮੈਂ ਨੇਚਰ ਦੀਆਂ ਪਿਕਚਰਸ ਕੈਦ ਕਰਦੀ ਰਹਿੰਦੀ ਸਾਂ ਤਾਂ ਇੱਕ ਵਾਰ ਇੱਦਾਂ ਹੀ ਮੇਰੀ ਅੱਗੇ ਮੇਰੀ ਪਿਕਚਰ ਮੇਂ ਕੋਈ ਇੰਟਰਨੈਟ 'ਤੇ ਪਾ ਤੀ ਅਤੇ ਉਹ ਵਾਇਰਲ ਹੋਈ ਅਤੇ ਫਿਰ ਉਹ ਮੇਰੇ ਇੱਦਾਂ ਹੀ ਨੋਨ ਦੇ ਵਿੱਚ ਕਿਸੇ ਨੇ ਉਹ ਪਿਕਚਰ ਅੱਗੇ ਕਿਸੇ ਸੰਸਥਾ ਨੂੰ ਦਿੱਤੀ ਤਾਂ ਉਹਨਾਂ ਨੇ ਮੈਨੂੰ ਸਨਮਾਨਿਤ ਕਰਨ ਲਈ ਬੁਲਾਇਆ ਤਾਂ ਇਹ ਮੇਰਾ ਇੱਕ ਯਾਦਗਾਰ ਪਲ ਰਿਹਾ ਰਹਿ ਚੁੱਕਿਆ ਹੈ